ਦਸ ਜਨਵਰੀ ਦੋ ਹਜ਼ਾਰ ਉੱਨੀ ਪੰਜ ਮਾਰਚ ਦੋ ਹਜ਼ਾਰ ਬਾਈ ਦਸ ਦਸੰਬਰ ਦੋ ਹਜ਼ਾਰ ਇੱਕੀ ਇੱਕ ਜਨਵਰੀ ਦੋ ਹਜ਼ਾਰ ਬਾਈ ਤਿੰਨ ਫਰਵਰੀ ਦੋ ਹਜ਼ਾਰ ਤੇਈ